ਪਿਛਲੇ ਸਾਲ ਨਾ ਜਨਵਰੀ ਦੇ ਵਿੱਚ ਮੇਰੀ ਕਜ਼ਨ ਜਿਹੜੀ ਸੀ ਕਹਿ ਰਹੀ ਸੀ ਕਹਿੰਦੀ ਕਿ ਮੈਂ ਕਿਤੇ ਬਾਹਰ ਜਾਣਾ ਹੈ ਮੈਂ ਘੁੰਮਣ ਜਾਣਾ ਹੈ ਫਿਰ ਕਰਦੇ ਕਰਾਉਂਦੇ ਅਸੀਂ ਇੱਕ ਪਲੈਨ ਕੀਤਾ ਗੋਆ ਜਾਣ ਦਾ ਗੋਆ ਅਸੀਂ ਕਦੇ ਗਏ ਨਹੀਂ ਸੀ ਸਾਡਾ ਫਸਟ ਟਾਈਮ ਸੀਗਾ ਅਤੇ ਚਲੋ ਉਹਨਾਂ ਦੇ ਪੇਰੈਂਟਸ ਵੀ ਮਤਲਬ ਚਲੇ ਨਾਲ ਚੱਲ ਪਏ ਅਸੀਂ ਜਲਦੀ ਚੱਲੇ ਅਤੇ ਅਸੀਂ ਦਿੱਲੀ ਪਹੁੰਚੇ ਹਾਂ ਅਤੇ ਦਿੱਲੀ ਬਾਏ ਏਅਰ ਜਾਣਾ ਸੀਗਾ ਬਾਏ ਏਅਰ ਜਾਣਾ ਮਤਲਬ ਸਾਡਾ ਫਸਟ ਐਕਸਪੀਰੀਅਸ ਸੀਗਾ ਅਤੇ ਅਸੀਂ ਜਦੋਂ ਮਤਲਬ ਜਹਾਜ ਦੇ ਵਿੱਚ ਪਹਿਲਾਂ ਤਾਂ ਅਸੀਂ ਏਅਰਪੋਰਟ 'ਤੇ ਐਂਟਰ ਕੀਤੇ ਉਦੋਂ ਫਿਰ ਚੈਕਿਨ ਹੋ ਗਿਆ ਅਸੀਂ ਅੰਦਰ ਬੈਠ ਗਏ ਅਤੇ ਜਦੋਂ ਫਿਰ ਸਾਨੂੰ ਸੀਗਾ ਕਿ ਮਤਲਬ ਵਿੰਡੋ ਸੀਟ ਮਿਲੇ ਕੁਦਰਤੀ ਚਲੋ ਸਾਨੂੰ ਵਿੰਡੋ ਹੀ ਮਿਲ ਗਈ ਅਸੀਂ ਵਿੰਡੋ ਸੀਟ ਦੇ ਵਿੱਚ ਬੈਠੇ ਸਾਨੂੰ ਬੜੀ ਐਕਸਾਈਟਮੈਂਟ ਸੀਗੀ ਸਾਨੂੰ ਇੱਕ ਥੋੜ੍ਹਾ ਜਿਹਾ ਡਰ ਘੱਟ ਲੱਗ ਰਿਹਾ ਸੀਗਾ ਬਟ ਐਕਸਪੀਰੀਸ ਅ ਅ ਜਿਹੜਾ ਹੈਗਾ ਉਹਨੂੰ ਕੀ ਕਹਿੰਦੇ ਹੈ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਅਤੇ ਜਦੋਂ ਜਹਾਜ਼ ਚੱਲਿਆ ਹਲਕਾ ਜਿਹਾ ਲੱਗਾ ਅਤੇ ਉਸ ਤੋਂ ਬਾਅਦ ਜਦੋਂ ਮਤਲਬ ਅ ਮਤਲਬ ਅਸੀਂ ਦੇਖਦੇ ਬੱਦਲ ਦੇਖੇ ਹੈ ਫਿਰ ਅਸੀਂ ਜਦੋਂ ਅਸੀਂ ਐਨ ਹਾਈਟ 'ਤੇ ਗਿਆ ਫਿਰ ਸਾਨੂੰ ਲੱਗਾ ਕਿ ਇਹ ਤਾਂ ਹੱਲ ਚੱਲ ਹੀ ਨਹੀਂ ਰਿਹਾ ਬਟ ਉਹ ਚੱਲ ਇੱਥੇ ਸੀ ਅਤੇ ਉਹ ਸਾਨੂੰ ਨਹੀਂ ਪਤਾ ਲੱਗ ਰਿਹਾ ਸੀ ਹੈ ਨਾ ਕਿ ਚੱਲ ਰਿਹਾ ਸੀ ਚਲੋ ਦੋ ਘੰਟੇ ਅਤੇ ਅਸੀਂ ਜਿਹੜਾ ਹੈਗਾ ਗੋਆ ਪਹੁੰਚ ਗਏ ਗੋਆ ਅਸੀਂ ਹੋਟਲ ਪਹਿਲਾਂ ਹੀ ਬੁਕਿੰਗ ਕੀਤੀ ਹੋਈ ਸੀਗੀ ਅਤੇ ਸਟਾਫ ਨੇ ਸਾਨੂੰ ਰੂਮ ਦਿਖਾਏ ਚਲੋ ਰੂਮ ਬਹੁਤ ਅੱਛੇ ਸੀਗੇ ਬੜੇ ਵਧੀਆ ਸੀਗੇ ਅਸੀਂ ਥੋੜ੍ਹੀ ਰੈਸਟ ਕੀਤੀ ਅਤੇ ਰੈਸਟ ਕਰਨ ਤੋਂ ਬਾਅਦ ਅਸੀਂ ਲਾਗੇ ਇੱਕ ਮ ਮਤਲਬ ਮ ਮਾਰਕੀਟ ਜਿਹੜੀ ਸੀ ਕਿ ਉਹ ਸ਼ਾਮ ਹੋ ਕੇ ਤੁਸੀਂ ਥੋੜ੍ਹੀ ਤੀ ਮਤੇ ਮਤਲਬ ਥੱਕੇ ਵੀ ਹੋਏ ਸੀ ਬਹੁਤਾ ਅਸੀਂ ਬੀਚ 'ਤੇ ਜਾਣ ਦੀ ਬਜਾਏ ਅਸੀਂ ਥੋੜ੍ਹਾ ਜਿਹਾ ਮਾਰਕੀਟ ਘੁੰਮੇ ਹਾਂ ਅਤੇ ਮਾਰਕੀਟ ਘੁੰਮ ਘੁੰਮਾ ਕੇ ਅਸੀਂ ਫਿਰ ਜਦੋਂ ਚਲੋ ਰਾਤ ਨੂੰ ਖਾਣਾ ਖਾਧਾ ਅਤੇ ਰੈਸਟ ਕੀਤੀ ਤਾਂ ਅਰਲੀ ਸਵੇਰੇ ਜਦੋਂ ਅਸੀਂ ਬੀਚ ਲਈ ਤੁਰ ਪਏ ਅਸੀਂ ਉੱਥੋਂ ਦੇ ਕਿੰਨੇ ਬੀਚ ਦੇਖੇ ਮਤਲਬ ਤਰ੍ਹਾਂ ਤਰ੍ਹਾਂ ਦੇ ਪਰ ਬੀਚ 'ਤੇ ਜਾ ਕੇ ਮਜਾ ਬੜਾ ਆਇਆ ਅਤੇ ਪਤਾ ਸਾਰੇ ਬੀਚ ਦੇਖੇ ਸਾਰੇ ਕੁਛ ਕੁ ਬੀਚ ਬ ਥੋੜ੍ਹੇ ਗੰਦੇ ਲੱਗੇ ਸਾਨੂੰ ਤਾਂ ਬਟ ਮੋਰ ਜਿਹੜੇ ਮੇਰਾ ਜ਼ਿੰਦਗੀ ਦਾ ਜਿਹੜਾ ਸਭ ਤੋਂ ਮ ਜਿਹੜਾ ਵਧੀਆ ਐਕਸਪੀਰੀਐਂਸ ਇਹ ਇੱਥੇ ਜਾਣ ਦਾ ਰਿਹਾ